ਅਗਰ ਆਪਾਂ ਗੱਲ ਕਰੀਏ ਆਵਾਜਾਈ ਅਤੇ ਸੜਕਾਂ ਦੇ ਹਲਾਤਾਂ ਦੇ ਬਾਰੇ ਤਾਂ ਆਪਾਂ ਕਈ ਜਗ੍ਹਾ ਜਾਂਦੇ ਹਾਂ ਜਿਵੇਂ ਕਿ ਕਈ ਜਗ੍ਹਾ ਦੇ ਵਿੱਚ ਆਪਾਂ ਨੂੰ ਆਵਾਜਾਈ ਅਤੇ ਸੜਕਾਂ ਦੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਆਪਾਂ ਗੱਲ ਕਰੀਏ ਨਿਊ ਡੈਲੀ ਬਾਰੇ ਨਿਊ ਡੈਲੀ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਵੇ ਜਾਂਦਾ ਹੈ ਕਿ ਉੱਥੇ ਸਾਨੂੰ ਜਾਮ ਦਾ ਜਾਮ ਦੀ ਬਹੁਤ ਆਵਾਜਾਈ ਦਾ ਬਹੁਤ ਸਮੱਸਿਆ ਹੁੰਦੀ ਹੈ ਇੱਕ ਸੌ ਮੀਟਰ ਜਦ ਇੱਕ ਕਿਲੋਮੀਟਰ ਤੱਕ ਜਾਣ ਨੂੰ ਵੀ ਘੰਟਾ ਡੇਢ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਐਦੀਂ ਗੱਲ ਕਰੀਏ ਆਪਾਂ ਮੁੰਬਈ ਦੀ ਮੁੰਬਈ ਦੇ ਵਿੱਚ ਵੀ ਇਹੋ ਜਿਹੇ ਹੀ ਆਵਾਜਾਈ ਦੀ ਸਮੱਸਿਆ ਹੈ ਆਪਾਂ ਗੱਲ ਕਰੀਏ ਸੜਕਾਂ ਦੀ ਸੜਕਾਂ ਦੀ ਜ਼ਿਆਦਾਤਰ ਸਮੱਸਿਆ ਟੁੱਟ ਭੰਨ ਖੱਡਿਆਂ ਦੀ ਸਮੱਸਿਆ ਆਪਾਂ ਨੂੰ ਪਿੰਡਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਜਿਸ ਜਿਵੇਂ ਕਿ ਸੜਕਾਂ ਦੇ ਵਿੱਚ ਟੋਏ ਪਏ ਹੁੰਦੇ ਹਨ ਜਿਸ ਦੇ ਨਾਲ਼ ਕੋਈ ਨਾ ਕੋਈ ਹਾਦਸਾ ਵਾਪਰ ਸਕਦਾ ਹੈ ਹਾਦਸਾ ਕਿਸੇ ਦੇ ਸੱਟ ਚੋਟ ਲੱਗ ਸਕਦੀ ਹੈ ਅਤੇ ਆਪਾਂ ਜ਼ਿਆਦਾਤਰ ਦੇਖ ਸਕਦੇ ਹਾਂ ਕਿ ਸਾਨੂੰ ਸਾਨੂੰ ਜ਼ਿਆਦਾਤਰ ਜਿਹੜੀਆਂ ਸ਼ਹਿਰਾਂ ਦੀਆਂ ਸੜਕਾਂ ਨੋਰਮਲ ਤੌਰ 'ਤੇ ਠੀਕ ਹੀ ਮਿਲਦੀਆਂ ਹਨ ਮਾੜਾ ਮੋਟਾ ਖੱਡਾ ਮਿਲਦਾ ਹੈ ਪਿੰਡਾਂ ਦੀ ਸੜਕਾਂ ਦੇ ਵਿੱਚ ਖੱਡਿਆਂ ਦੇ ਨਾਲ਼ ਹੀ ਭਰੀ ਹੁੰਦੀ ਹੈ